ਦਸ ਅਗਸਤ ਦੋ ਹਜ਼ਾਰ ਪੰਜ ਬਾਰਾਂ ਜਨਵਰੀ ਦੋ ਹਜ਼ਾਰ ਇੱਕ ਪੰਦਰਾਂ ਸਤੰਬਰ ਉੱਨੀ ਸੌ ਨੱਬੇ ਸੋਲ੍ਹਾਂ ਮਈ ਉੱਨੀ ਸੌ ਛਿਆਨਵੇਂ ਪੰਜ ਅਪ੍ਰੈਲ ਦੋ ਹਜ਼ਾਰ ਵੀਹ